ਗਾਇਕੀ ਦੇ ਪ੍ਰਦਰਸ਼ਨ ਦੀ ਮ ਵਾਰਮਅਪ ਬਾਰੇ ਮੈਂ ਤੁਹਾਡੇ ਨਾਲ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਮੈਂ ਪਹਿਲਾਂ ਕੁਝ ਮਿੰਟਾਂ ਲਈ ਆਵਾਜ਼ ਨੂੰ ਵਾਰਮਅਪ ਕਰਦਾ ਹਾਂ ਇਸ ਵਿੱਚ ਸੁਰ ਦੇ ਅਭਿਆਸ ਹੋ ਗਏ ਅਤੇ ਸਰੀਕਿੰਗ ਸਟਰੈਟਿੰਗ ਸ਼ਾਮਿਲ ਹੁੰਦੇ ਹਨ ਆਵਾਜ਼ ਨੂੰ ਵਾਰਮਅਪ ਕਰਨ ਲਈ ਮੈਂ ਹਰ ਸੁਰ ਦੇ ਅਭਿਆਸ ਅਤੇ ਸੁਰ ਸਾਧਨਾ ਦੀਆਂ ਕਵਾਇਤਾਂ ਕਰਦਾ ਹਾਂ ਇਸਦੇ ਨਾਲ ਆਵਾਜ਼ ਮਿੱਠੀ ਹੁੰਦੀ ਹੈ ਅਤੇ ਸੁਰ ਦੇ ਚੜਾਅ ਉਤਰਾਅ ਵਿੱਚ ਸੁਧਾਰ ਹੁੰਦਾ ਹੈ ਹਾਈਡਰੇਸ਼ਨ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਸ਼ੈਸ਼ਨ ਤੋਂ ਪਹਿਲਾਂ ਪ ਅਤੇ ਦੌਰਾਨ ਮੈਂ ਬਹੁਤ ਸਾਰਾ ਪਾਣੀ ਪੀਂਦਾ ਹਾਂ ਜਿਸ ਨਾਲ ਹਲਕਾ ਸੁੱਕਾ ਗਲਾ ਤਰ ਹੋ ਜਾਂਦਾ ਹੈ ਗਲਾ ਮੇਰਾ ਸੁੱਕਾ ਨਹੀਂ ਰਹਿੰਦਾ ਆਵਾਜ਼ ਸੱਚੀ ਨਿਕਲਦੀ ਹੈ ਵਧੀਆ ਮਿੱਠੀ ਅਵਾਜ਼ ਨਿਕਲਦੀ ਹੈ ਗਲਾ ਪ੍ਰਤਿਕਿਰਿਆ ਰਿਹੈਸਲ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੀਤਾਂ ਦਾ ਕਈ ਵਾਰ ਅਭਿਆਸ ਕਰਦਾ ਹਾਂ ਇਹ ਪੱਕਾ ਕਰਨ ਲਈ ਕਿ ਮੈਂ ਸਾਰੇ ਸ਼ਬਦ ਸੁਰ ਅਤੇ ਤਾਲ ਠੀਕ ਯਾਦ ਕਰ ਕਰਨ ਲਈ ਮੈਂ ਰਹੈਸਲ ਕਰਦਾ ਹਾਂ ਮਾਨਸਿਕ ਤਿਆਰੀ ਮੈਂ ਸ਼ੈਸ਼ਨ ਤੋਂ ਪਹਿਲਾਂ ਕੁਝ ਸਮਾਂ ਸ਼ਾਂਤੀ ਨਾਲ ਬਿਤਾਉਂਦਾ ਹਾਂ ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਇਕੱਲਾ ਰਹਿ ਕੇ ਮਾਨਸਿਕਤਾ ਪੂਰਾ ਮਤਲਬ ਆਪਣੇ ਮਾਨਸਿਕ ਤਿਆਰ ਹੋ ਕੇ ਗਹਿਰੀ ਸਾਹ ਲੈ ਕੇ ਰਵਾਇਤਾਂ ਦਾ ਯੋਗ ਕਰਕੇ ਆਪਣੇ ਮਨ ਨੂੰ ਸ਼ਾਂਤ ਅਤੇ ਕੋਵਿਤ ਕਰਦਾ ਹਾਂ ਸਰੀਰਕ ਸਿਹਤ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸ਼ੈਸ਼ਨ ਤੋਂ ਕੁਝ ਦਿਨ ਪਹਿਲਾਂ ਮੈਂ ਮਸਾਲੇਦਾਰ ਅਤੇ ਠੰਡੇ ਪਦਾਰਥਾਂ ਤੋਂ ਬਚਾਅ ਕਰਦਾ ਹਾਂ ਜਿਹਦੇ ਵਿੱਚ ਆਈਸਕ੍ਰੀਮ ਅਲੱਗ ਅਲੱਗ ਜੋ ਵੀ ਮਤਲਬ ਅ ਤਲੀਆਂ ਹੋਈਆਂ ਚੀਜ਼ਾਂ ਉਹਨਾਂ ਤੋਂ ਜ਼ਿਆਦਾ ਠੰਡੀਆਂ ਮਸਾਲੇਦਾਰ ਚੀਜ਼ਾਂ ਇਹਨਾਂ ਦਾ ਮੈਂ ਪਰਹੇਜ਼ ਕਰਦਾ ਹਾਂ ਮੇਰਾ ਗਲਾ ਠੀਕ ਰਹੇ ਪ੍ਰੋਫੈਸ਼ਨਲ ਦੀ ਤਿਆਰੀ ਜੇਕਰ ਸ਼ੈਸ਼ਨ ਵੱਡਾ ਹੈ ਤਾਂ ਆਪਣੀ ਕਲਾਕਾਰੀ ਦੇ ਪ੍ਰਵੇਸ਼ਨ ਬਿੰਦੂਆਂ ਨੂੰ ਵੇਖਦਾ ਹਾਂ ਅਤੇ ਜੇਕਰ ਲੋੜ ਹੋਵੇ ਤਾਂ ਨੋਟਿਸ ਬਣਾਉਂਦਾ ਹਾਂ ਅਤੇ ਉਹਨੂੰ ਰਾਈਟ ਕਰਕੇ ਲਿਖ ਕੇ ਜੋ ਵੀ ਮਤਲਬ ਮੈਂ ਕੋਈ ਕਿਸੇ ਅੱਗੇ ਮਤਲਬ ਮੈਂ ਕੋਈ ਸਟੇਜ 'ਤੇ ਜਾਂ ਕਿਤੇ ਵੀ ਮਤਲਬ ਜਾ ਕੇ ਵੀ ਮੈਂ ਆਪਣੀ ਤਿਆਰੀ ਕਰਨੀ ਹੁੰਦੀ ਹੈ ਬੋਲਣਾ ਹੁੰਦਾ ਜਾਂ ਗਾਉਣਾ ਹੁੰਦਾ ਉਹਦੇ ਲਈ ਮੈਂ ਮਤਲਬ ਪਹਿਲਾਂ ਇੱਕ ਡਾਇਰੀ ਹੋਈ ਰੱਖਦਾ ਹਾਂ ਡਾਇਰੀ ਦੇ ਉੱਪਰ ਉਹਦੀ ਵਾਰ ਵਾਰ ਮੈਂ ਕਾ ਕਰਦਾ ਹਾਂ ਲਾਸਟ 'ਤੇ ਮੇਰਾ ਬਹੁਤ ਬਹੁਤ ਧੰਨਵਾਦ